ਹਾਂਜੀ ਅੱਜ ਗੱਲ ਕਰਾਂਗੇ ਜੋ ਕਿ ਮੈਂ ਪਿਛਲੇ ਸਮੇਂ ਵਿੱਚ ਇੱਕ ਡਰਿੱਲ ਮੰਗਵਾਈ ਸੀ ਉਸ ਦੇ ਬਾਰੇ ਮੈਂ ਆਪਣੇ ਘਰੇਲੂ ਕੰਮਾਂ ਲਈ ਪਿਛਲੇ ਵੀਹ ਪੱਚੀ ਦਿਨ ਪਹਿਲਾਂ ਇੱਕ ਡਰਿੱਲ ਮੰਗਵਾਈ ਸੀ ਜਿਸਦੇ ਕਿ ਮੈਂ ਅੱਜ ਤੁਹਾਨੂੰ ਫਾਇਦੇ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਾਂਗਾ ਕਿ ਇਹ ਡਰਿੱਲ ਬਹੁਤ ਹੀ ਵਧੀਆ ਅਤੇ ਸਸਤੇ ਰੇਟ ਵਿੱਚ ਮੈਨੂੰ ਮਿਲੀ ਇਸ ਨਾਲ ਮੈਂ ਆਪਣੇ ਸਭ ਸਾਰੇ ਕੰਮ ਬਹੁਤ ਹੀ ਆਸਾਨੀ ਨਾਲ ਕਰ ਸਕਿਆ ਇਸ ਡਰਿੱਲ ਵਿੱਚ ਮੈਨੂੰ ਪੰਜ ਤਰ੍ਹਾਂ ਦੀਆਂ ਬਿੱਟਾਂ ਮਿਲੀਆਂ ਜੋ ਕਿ ਅਲੱਗ ਅਲੱਗ ਤਰ੍ਹਾਂ ਦੇ ਕੰਧ ਵਿੱਚ ਛੇਕ ਕਰਦੀਆਂ ਹਨ ਜਿਵੇਂ ਕਿ ਹਰ ਬਿਟ ਦਾ ਆਪਣਾ ਆਪਣਾ ਕੰਮ ਹੈ ਅਤੇ ਸਭ ਤੋਂ ਵਧੀਆ ਗੱਲ ਇਹ ਕਿ ਇਹ ਡਰਿੱਲ ਯੂਜ਼ ਕਰਨੀ ਬਹੁਤ ਹੀ ਜ਼ਿਆਦਾ ਵਧੀਆ ਹੈ ਅਤੇ ਇਸ ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਇਹ ਹੋਰਾਂ ਡਰਿੱਲਾਂ ਨਾਲੋਂ ਵਜ਼ਨ ਵਿੱਚ ਵੀ ਥੋੜ੍ਹੀ ਵਧੀਆ ਹੈ ਇਸਦਾ ਵਜ਼ਨ ਘੱਟ ਹੈ ਇਸਨੂੰ ਚੱਕਣਾ ਵੀ ਆਸਾਨ ਹੈ ਪਰ ਜੇਕਰ ਆਪਾਂ ਦੇਖਿਆ ਜਾਵੇ ਹੋਰ ਡਰਿੱਲਾਂ ਜਿਵੇਂ ਕਿ ਮਿਲਦੀਆਂ ਹਨ ਉਹ ਬਹੁਤ ਜ਼ਿਆਦਾ ਵਜ਼ਨ ਵਿੱਚ ਭਾਰੀਆਂ ਹੁੰਦੀਆਂ ਹਨ ਅਤੇ ਹਰ ਕੋਈ ਉਸਨੂੰ ਯੂਜ਼ ਨਹੀਂ ਕਰ ਸਕਦਾ ਪਰ ਇਸ ਡਰਿ ਡਰਿੱਲ ਬਾਰੇ ਮੈਂ ਖੁੱਲ੍ਹ ਕੇ ਕਹਿ ਸਕਦਾ ਕਿ ਮੈਨੂੰ ਬਹੁਤ ਹੀ ਸਸਤੇ ਰੇਟ 'ਤੇ ਬਹੁਤ ਹੀ ਵਧੀਆ ਡਰਿੱਲ ਪ੍ਰਾਪਤ ਹੋਈ ਜਿਸ ਕਰਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ